ਪੰਜਾਬ ਵਿੱਚ ਸਭ ਤੋਂ ਮਹਾਨ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਇੱਥੇ ਵੱਖ ਵੱਖ ਧਰਮਾਂ ਦੇ ਲੋਕ ਰਹਿੰਦੇ ਹਨ ਅਤੇ ਹਰ ਕੋਈ ਆਪਣੇ ਧਰਮ ਨੂੰ ਮੰਨਦਾ ਹੈ ਹਰ ਇੱਕ ਧਰਮ ਦੇ ਆਪਣੇ ਆਪਣੇ ਗ੍ਰੰਥ ਨੇ ਜਿਸ ਤਰ੍ਹਾਂ ਕਿ ਸਿੱਖਾਂ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਿੰਦੂਆਂ ਦੇ ਵੇਦ ਮੁਸਲਮਾਨਾਂ ਦੇ ਕੁਰਾਨ ਇਸਾਈਆਂ ਦੇ ਬਾਈਬਲ ਉਹ ਹਰ ਧਰਮ ਆਪਣਾ ਆਪਣਾ ਮੰਨਦਾ ਹੈ ਜਿਸ ਤਰ੍ਹਾਂ ਕਿ ਸਾਨੂੰ ਸਿੱਖਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਅੰਮ੍ਰਿਤ ਛਕੋ ਅੰਮ੍ਰਿਤ ਵਾਲੇ ਬਣੋ ਬਾਣੀ ਬਾਣੇ ਦੇ ਧਾਰਨੀ ਬਣੋ ਅੰਮ੍ਰਿਤ ਵੇਲੇ ਜਾਗਣਾ ਨਿਤਨੇਮ ਨਾਲ ਜੁੜਨਾ ਸ਼ਾਮ ਨੂੰ ਰਹਿਰਾਸ ਸਾਹਿਬ ਕਰਨਾ ਰਾਤ ਨੂੰ ਕੀਰਤਨ ਸੋਹਿਲਾ ਦਾ ਪਾਠ ਕਰਨਾ ਸਾਡੇ ਵਾਸਤੇ ਜ਼ਰੂਰੀ ਹੈ ਅਤੇ ਇਸ ਤੋਂ ਇਲਾਵਾ ਹੋਰ ਵੀ ਬਾਣੀਆਂ ਅਸੀਂ ਪੜ੍ਹ ਸਕਦੇ ਹਾਂ ਵੇਦ ਆਪਣੇ ਜਿਹੜੇ ਚਾਰ ਵੇਦ ਨੇ ਸ਼ਮ ਸਿਮ੍ਰਤੀਆਂ ਸਸ਼ਟਸ ਹਿੰਦੂ ਲੋਕ ਪੜ੍ਹਦੇ ਨੇ ਕੁਰਾਨ ਪੰਜ ਵੇਲੇ ਦੀ ਨਮਾਜ਼ ਮੁਸਲਮਾਨ ਜ਼ਰੂਰੀ ਪੜ੍ਹਦਾ ਹੈ ਜਿੱਥੇ ਵੀ ਹੋਵੇ ਉਸਨੇ ਆਪਣੇ ਨਮਾਜ਼ ਪ ਨਮਾਜ਼ ਪੜ੍ਹਨੀ ਜ਼ਰੂਰੀ ਸਮਝਦਾ ਹੈ ਇਸਾਈ ਭੈਣ ਭਰਾ ਸਾਡੇ ਜਿਹੜੇ ਨੇ ਉਹ ਬਾਈਬਲ ਨੂੰ ਪੜ੍ਹਦੇ ਨੇ ਅਤੇ ਤ ਕਈਆਂ ਦੇ ਤਾਂ ਆਪਣੇ ਆਪਣੇ ਕੋਲ ਹੀ ਬਾਈਬਲ ਰੱਖੀ ਹੁੰਦੀ ਹੈ ਜਿੱਥੇ ਵੀ ਉਹਨਾਂ ਦਾ ਮਨ ਮੰਨਦਾ ਜਿੱਥੇ ਵੀ ਬਾਹਰ ਬੈਠ ਕੇ ਉਹ ਬਾਈਬਲ ਆਪਣੀ ਖੋਲ੍ਹ ਕੇ ਪੜ੍ਹ ਲੈਂਦੇ ਹਨ ਇਸ ਤਰ੍ਹਾਂ ਹੀ ਸਾਨੂੰ ਹਰ ਇੱਕ ਧਰਮ ਨੂੰ ਮੰਨਣਾ ਚਾਹੀਦਾ ਹੈ ਇਹ ਨਹੀਂ ਕਿ ਜੇ ਸਿੱਖਾਂ ਹਾਂ ਤਾਂ ਅਸੀਂ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਸਾਡੇ ਵਾਸਤੇ ਸਾਰੇ ਹੀ ਗ੍ਰੰਥ ਪੂਜਨੀਕ ਹਨ ਅਤੇ ਬਾਕੀਆਂ ਵਾਸਤੇ ਵੀ ਇਹੀ ਚਾਹੀਦਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਕੇ ਵੇਦ ਆਪਣੇ ਸ਼ਾਸਤਰ ਸਿਮ੍ਰਤੀਆਂ ਨੂੰ ਮੰਨ ਕੇ ਕੁਰਾਨ ਬਾਈਬਲ ਨੂੰ ਮੰਨ ਕੇ ਹੀ ਉਹਨਾਂ ਨੂੰ ਪਰਮਾਤਮਾ ਦਾ ਇੱਕੋ ਹੀ ਰੂਪ ਹੈ ਉਹਨਾਂ ਨੂੰ ਸਾਨੂੰ ਸਭ ਨੂੰ ਪੂਜਣਾ ਚਾਹੀਦਾ ਹੈ ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ਪਰਮਾਤਮਾ ਇੱਕ ਹੈ ਪਰਮਾਤਮਾ ਨੂੰ ਹਰ ਥਾਂ 'ਤੇ ਵਸਦਾ ਹੈ ਚਾਹੇ ਉਹ ਕਿਸੇ ਵੀ ਧਰਮ ਦੇ ਕੋਈ ਲੋਕ ਹੋਣਗੇ ਉਹਨਾਂ ਨੂੰ ਪਰਮਾਤਮਾ ਜੇਕਰ ਉਹਨਾਂ ਨੂੰ ਪਰਮਾਤਮਾ 'ਤੇ ਵਿਸ਼ਵਾਸ ਹੈ ਤਾਂ ਉਹ ਸਭ ਇੱਕੋ ਧਰਮ ਨੂੰ ਹੀ ਮੰਨਣਗੇ